ਚਿੱਤਰਕਾਰੀ ਕਰਦੇ ਸਮੇਂ ਮੈਂ ਡੋਮਸ ਦੀਆਂ ਪੈਂਸਿਲਸ ਸਕੈਚ ਅਤੇ ਪੈਂਸਿਲਸ ਸਕੈਚ ਅਤੇ ਵੈਕਸ ਕਲਰ ਯੂਜ਼ ਕਰਨਾ ਪਸੰਦ ਕਰਦੀ ਹਾਂ ਕਿਉਂਕਿ ਇਹ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਹਨ ਅਤੇ ਜਦੋਂ ਅਸੀਂ ਇਹਨਾਂ ਨਾਲ ਸਕੈਚ ਵਗੈਰਾ ਕਰਦੇ ਹਾਂ ਤਾਂ ਤਾਂ ਇਹ ਕਲਰ ਉੱਭਰ ਕੇ ਆਉਂਦੇ ਹਨ ਜੋ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ ਅਤੇ ਮੈਂ ਕੈਮਲ ਦੇ ਵਾਟਰ ਵਾਟਰ ਕਲਰ ਯੂਜ ਕਰਦੀ ਹਾਂ ਜੋ ਜਿੰ ਜੋ ਸ਼ੀਟ 'ਤੇ ਫੈਲਦੇ ਨਹੀਂ ਹਨ ਅਤੇ ਉਹ ਨਾਲ ਵੀ ਬਹੁਤ ਵਧੀਆ ਪੇਂਟਿੰਗ ਹੁੰਦੀ ਹੈ ਅਤੇ ਉਹ ਵੀ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ ਮੇਰੇ ਪਸੰਦੀਦਾ ਬ੍ਰਾਂਡ ਜ਼ਿਆਦਾਤਰ ਡੋਮਸ ਹੀ ਹਨ ਮੈਂ ਡੋਮਸ ਦੀਆਂ ਹੀ ਪੈਂਸਿਲਸ ਡੋਮਸ ਦੇ ਸਕੈਚ ਡੋਮਸ ਦੇ ਹੀ ਸਟੇਸ਼ਨਰੀ ਯੂਜ ਕਰਦੀ ਹਾਂ ਕਿਉਂਕਿ ਬਹੁਤ ਵਧੀਆ ਬ੍ਰੈਂਡ ਹੈ ਅੱਜ ਦੇ ਸਮੇਂ ਵਿੱਚ ਜੋ ਵੀ ਅਸੀਂ ਪੇਂਟਿੰਗ ਕਰਦੇ ਹਾਂ ਅਤੇ ਇਸ ਨੂੰ ਮੈਂ ਸ਼ਰਮਾ ਬੁੱਕ ਡਿਪੋਟ ਤੋਂ ਖਰੀਦਦੀ ਹਾਂ ਜਿੱਥੇ ਮੈਨੂੰ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਮਿਲ ਜਾਂਦੇ ਹਨ ਏਮ ਅਤੇ ਸਸਤੇ ਵੀ ਮਿਲ ਜਾਂਦੇ ਹਨ ਕਿਉਂਕਿ ਜਦੋਂ ਅਸੀਂ ਸਾਰਾ ਸਮਾਨ ਇਕੱਠਾ ਲੈਂਦੇ ਹਾਂ ਤਾਂ ਸਾਨੂੰ ਡਿਸਕਾਊਂਟ ਤਾਂ ਮਿਲਦਾ ਹੀ ਮਿਲਦਾ ਹੈ ਇਸ ਕਰਕੇ ਅਸੀਂ ਸਾਰਾ ਸਮਾਨ ਇਕੱਠਾ ਲੈ ਆਉਂਦੇ ਹਾਂ